ਜੇਕਰ ਅੱਜ ਦੇ ਸਮੇਂ ਵਿੱਚ ਗੱਲ ਕੀਤੀ ਜਾਵੇ ਤਾਂ ਸੰਗੀਤ ਸਾਜ਼ ਵਜਾਉਣਾ ਸਾਨੂੰ ਬਿਲਕੁਲ ਵੀ ਨਹੀਂ ਆਉਂਦਾ ਅਤੇ ਪ੍ਰੰਤੂ ਮੈਨੂੰ ਸੰਗੀਤ ਸਾਜ਼ ਸੁਣਨਾ ਬਹੁਤ ਹੀ ਜ਼ਿਆਦੇ ਵਧੀਆ ਲੱਗਦਾ ਹੈ ਅਤੇ ਮੈਂ ਇਸ ਨੂੰ ਸੁਣ ਕੇ ਬਹੁਤ ਹੀ ਪ੍ਰਭਾਵਿਤ ਹੁੰਦਾ ਹਾਂ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਦੇ ਟਾਈਮ ਵਿੱਚ ਮੈਨੂੰ ਉੱਚੀਆਂ ਚੱਕਵੀਆਂ ਬੀਟਾਂ ਸੁਣਨੀਆਂ ਬਹੁਤ ਵਧੀਆ ਲੱਗਦੀਆਂ ਹਨ ਜਿਵੇਂ ਕਿ ਆਪਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਹੀ ਗੱਲ ਕਰਦੇ ਹਾਂ ਉਸ ਦੇ ਗਾਣਿਆ ਦੇ ਵਿੱਚ ਬਹੁਤ ਸਾਰੀਆਂ ਚੱਕਵੀਆਂ ਬੀਟਾਂ ਹੁੰਦੀਆਂ ਹਨ ਅਤੇ ਉਸ ਦੇ ਗਾਣੇ ਦਾ ਸਾਜ਼ ਬਹੁਤ ਹੀ ਵਧੀਆ ਹੁੰਦਾ ਹੈ ਉਸ ਨਾਲ਼ ਮਨ ਨੂੰ ਸਕੂਨ ਵੀ ਮਿਲਦਾ ਹੈ ਅਤੇ ਦਿਲ ਨੂੰ ਸ਼ਾਂਤੀ ਅਤੇ ਬਹੁਤ ਸਾਰੀ ਖੁਸ਼ੀ ਵੀ ਮਿਲਦੀ ਹੈ ਇਸ ਤਰ੍ਹਾਂ ਜੇਕਰ ਕੋਈ ਅਸੀਂ ਸਾਜ਼ ਸਿੱਖਣਾ ਹੋਵੇ ਤਾਂ ਉਸ ਵਿੱਚੋਂ ਮੈਂ ਤੂੰਬੀ ਨੂੰ ਸਿੱਖਣਾ ਬਹੁਤ ਹੀ ਪਸੰਦ ਕਰਾਂ ਹਾਂ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਪੁਰਾਣੀ ਸਾਜ਼ ਦੇ ਤੌਰ 'ਤੇ ਤੂੰਬੀ ਬਹੁਤ ਹੀ ਪ੍ਰਸਿੱਧ ਹੁੰਦੀ ਆ ਰਹੀ ਹੈ ਧੰਨਵਾ